ਇੱਕ ਅਗਸਤ ਦੋ ਹਜ਼ਾਰ ਚੌਵੀ ਦੋ ਅਗਸਤ ਦੋ ਹਜ਼ਾਰ ਚੌਵੀ ਤਿੰਨ ਅਗਸਤ ਦੋ ਹਜ਼ਾਰ ਚੌਵੀ ਚਾਰ ਅਗਸਤ ਦੋ ਹਜ਼ਾਰ ਚੌਵੀ ਪੰਜ ਅਗਸਤ ਦੋ ਹਜ਼ਾਰ ਚੌਵੀ